ਆਪਾਂ ਲੰਮੀ ਤੈਰਾਕੀ ਦੀ ਗੱਲ ਕਰ ਰਹੇ ਸੀ ਅਤੇ ਇਹਦੇ ਨਾਲ ਜੁੜੇ ਸਾਨੂੰ ਪੋਸ਼ਕ ਆਹਾਰ ਆ ਅਸੀਂ ਉਹਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਹੜੇ ਆਪਾਂ ਗੱਲ ਕਰੀਏ ਕਿ ਜ਼ਿਆਦਾ ਤੋਂ ਜ਼ਿਆਦਾ ਆਪਾਂ ਨੂੰ ਕੀ ਸ ਸਲਾਦ ਜਿਹੜਾ ਹੈਗਾ ਉਹ ਖਾਣਾ ਚਾਹੀਦਾ ਹੈ ਲਾਈਟ ਚੀਜ਼ਾਂ ਖਾਣੀਆਂ ਚਾਹੀਦੀਆਂ ਜਿਹੜਾ ਪੇਟ ਨੂੰ ਹਲਕਾ ਰੱਖਣ ਰਫੇਜ਼ ਲੈਣਾ ਚਾਹੀਦਾ ਹੈ ਲਾਈਟ ਡਾਇਟ ਲੈਣੀ ਚਾਹੀਦੀ ਹੈ ਪ੍ਰੋਟੀਨ ਲੈਣਾ ਚਾਹੀਦਾ ਹੈ ਪ੍ਰੋਟੀਨ ਲੈਣਾ ਚਾਹੀਦਾ ਫੈਟ ਘੱਟ ਤੋਂ ਘੱਟ ਲੈਣਾ ਚਾਹੀਦਾ ਹੈ ਹੋਰ ਕੀ ਹੈ ਕਿ ਇਹਦੇ 'ਚ ਪੂਰੇ ਜਿਹੜਾ ਹੈਗਾ ਆਪਦਾ ਇੱਕ ਰੋਜ਼ਾਨਾ ਦਾ ਡਾਇਟ ਚਾਰਟ ਬਣਾ ਕੇ ਉਹਨੂੰ ਫੋਲੋ ਕਰਨਾ ਚਾਹੀਦਾ ਰੈਗੂਲਰ ਸਵਿੰਗ 'ਤੇ ਜਾਣਾ ਚਾਹੀਦਾ ਹੋਰ ਹਾਈਡਰੇਟਿਡ ਰਹਿਣ ਲਈ ਸਾਨੂੰ ਕੀ ਕਰਨਾ ਚਾਹੀਦਾ ਕਿ ਇਹਦੇ ਵਾਸਤੇ ਡਿਫਰੈਂਟ ਡਿਫਰੈਂਟ ਕੀ ਆ ਉਹ ਵੀ ਆਉਂਦੇ ਨੇ ਵੱਖ ਵੱਖ ਜਿਵੇਂ ਕੋ ਕੋ ਸਪਲੀਮੈਂਟਸ ਵੀ ਆਉਂਦੇ ਨੇ ਪ੍ਰੋਟੀਨ ਆਉਂਦਾ ਅਮੀਨੋ ਐਸਡ ਆਉਂਦਾ ਹੈ ਆਪਾਂ ਪ੍ਰੋਟੀਨ ਦੇ ਤੌਰ 'ਤੇ ਚਾਹੀਏ ਤਾਂ ਉਬਾਲ ਕੇ ਅੰਡਾ ਖਾ ਸਕਦੇ ਹਾਂ ਇਹ ਚੀਜ਼ਾਂ ਸਾਨੂੰ ਮਦਦ ਕਰਦੀਆਂ ਲੰਬੀ ਤੈਰਾਕੀ ਦੇ ਅਭਿਆਸ ਨੂੰ ਸਫਲ ਹੋਣੇ 'ਚ ਬਹੁਤ ਬਹੁਤ ਧੰਨਵਾਦ